ਮੈਂ ਇੱਕ ਵਿੱਤੀ ਸੰਮੇਲਨ ਵਿੱਚ ਗਿਆ ਮੈਂ ਉੱਥੇ ਦੇਖਿਆ ਕਿ ਵੱਖ ਵੱਖ ਵਰਗਾਂ ਦੇ ਲੋਕ ਓਥੇ ਉਸ ਸੰਮੇਲਨ ਵਿੱਚ ਆਏ ਸਨ ਜੋ ਕਿ ਸਾਨੂੰ ਦੱਸ ਰਹੇ ਸਨ ਕਿ ਸਾਨੂੰ ਕਿਸ ਤਰ੍ਹਾਂ ਆਪਣਾ ਨਿਵੇਸ਼ ਕਰਨਾ ਚਾਹੀਦਾ ਹੈ ਅਤੇ ਮੈਂ ਉੱਥੇ ਉਸ ਜਗ੍ਹਾ 'ਤੇ ਸੰਮੇਲਨ ਵਿੱਚ ਜਾ ਕੇ ਦੇਖਿਆ ਕਿ ਕਿ ਉਹ ਇੱਕ ਸਕੀਮ ਐਨਪੀਐੱਸ ਸਕੀਮ ਦੱਸ ਰਹੇ ਸਨ ਜਿਹੜੀ ਕਿ ਮੈਨੂੰ ਬਹੁਤ ਹੀ ਜ਼ਿਆਦਾ ਫਾਇਦੇਮੰਦ ਲੱਗੀ ਅਤੇ ਮੈਂ ਵੀ ਇਸ ਸਕੀਮ ਦਾ ਲਾਭ ਲੈਣਾ ਚਾਹੁੰਦਾ ਸੀ ਸੋ ਇਸ ਕਰਕੇ ਮੈਂ ਉਨ੍ਹਾਂ ਨਾਲ ਗੱਲ ਕਰੀ ਅਤੇ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਇਸ ਲਈ ਇੱਕ ਔਨਲਾਈਨ ਫਾਰਮ ਭਰਨਾ ਪਏਗਾ ਸੋ ਮੈਂ ਇੱਕ ਉਹ ਔਨਲਾਈਨ ਫਾਰਮ ਭਰਿਆ ਜਿਸ ਦੇ ਵਿੱਚ ਮੈਂ ਆਪਣਾ ਨਾਮ ਫਾਦਰ ਨੇਮ ਮਾਤਾ ਦਾ ਨਾਂ ਐਡਰੈਸ ਜੋ ਵੀ ਮੇਰਾ ਹੋਰ ਡੌਕੂਮੈਂਟ ਸੀ ਉਹ ਸਾਰੇ ਮੈਂ ਉਸ ਫੋ ਓਨਲਾਇਨ ਫੋਮ ਵਿੱਚ ਫਿਲ ਕੀਤੇ ਅਤੇ ਮੈਂ ਆਪਣੀ ਉਹ ਐਨਪੀਐੱਸ ਸਕੀਮ ਲਈ ਆਪਣੀ ਦਰਜ ਕੀਤੀ ਸੋ ਉਨ੍ਹਾਂ ਨੇ ਮੈਨੂੰ ਆਪਣਾ ਐਨਪੀਐੱਸ ਨੰਬਰ ਪੁੱਛਿਆ ਜੋ ਕਿ ਸੀ ਪੀ ਬੀ ਜੀਰੋ ਇੱਕ ਤਿੰਨ ਚਾਰ ਸੋ ਮੈਂ ਵੀ ਉਨ੍ਹਾਂ ਨੂੰ ਉਹ ਆਪਣਾ ਨੰਬਰ ਦੱਸ ਕੇ ਦਰਜ ਕਰਵਾਇਆ ਥੈਂਕ ਯੂ ਸੋ ਮੱਚ